ਜੀ ਹਾਂ ਜਿਹੜੇ ਵੀ ਸਾਡੇ ਭਾਰਤ ਜਾਂ ਜਾਂ ਸਾਡੇ ਜਿਵੇਂ ਪੰਜਾਬ ਰਾਜ ਦੇ ਜਿਵੇਂ ਕਲਾ ਸ਼ੈਲੀਆਂ ਹਨ ਅਸੀਂ ਉਹਨਾਂ ਨੂੰ ਦੂਸਰੇ ਦੇਸ਼ਾਂ ਨੂੰ ਜ਼ਰੂਰ ਦਿਖਾਉਣਾ ਚਾਹਵਾਂਗੇ ਅਸੀਂ ਉਹਨਾਂ ਨੂੰ ਕਹਾਂਗੇ ਕਿ ਹਾਂ ਵੀ ਸਾਡੇ ਪੰਜਾਬ ਵਿੱਚ ਜਾਂ ਸਾਡੇ ਭਾਰਤ ਵਿੱਚ ਇਹ ਬਹੁਤ ਤਰ੍ਹਾਂ ਦੀਆਂ ਵੱਖ ਵੱਖ ਕਲਾਵਾਂ ਨੇ ਅਤੇ ਉਹ ਵੀ ਉਹਨਾਂ ਤੋਂ ਪ੍ਰੇਰਿਤ ਹੋਣ ਉਹ ਉਹਨਾਂ ਨੂੰ ਉਸ ਦੇ ਨਾਲ ਜਾਣੂ ਹੋਣ ਉਹਨਾਂ ਨੂੰ ਵੀ ਪਤਾ ਲੱਗੇ ਕਿ ਪੰਜਾਬ ਵਿੱਚ ਜਾਂ ਭਾਰਤ ਵਿੱਚ ਕਿਸ ਤਰ੍ਹਾਂ ਦੀਆਂ ਕਲਾਵਾਂ ਜੇ ਉਹ ਹੈ ਜਿਵੇਂ ਕਿ ਸਾਡੇ ਪੰਜਾਬ ਵਿੱਚ ਜਿਵੇਂ ਫੁਲਕਾਰੀਆਂ ਬੁਣਨਾ ਪੱਖੀਆਂ ਬੁਣਨਾ ਛਿੱਕੂ ਬੁਣਨਾ ਹਰ ਤਰ੍ਹਾਂ ਤਰ੍ਹਾਂ ਦੇ ਹੈ ਪੰਜਾਬ ਵਿੱਚ ਤਾਂ ਇਹ ਬਹੁਤ ਮਸ਼ਹੂਰ ਤੌਰ 'ਤੇ ਬਣਾਈਆਂ ਜਾਂਦੀਆਂ ਹਨ ਜੁੱਤੀਆਂ ਹੋ ਗਈਆਂ ਤਾਂ ਇਹਨਾਂ ਚੀਜ਼ਾਂ ਤੋਂ ਵੀ ਜਿਹੜੇ ਹੋਰ ਜਿਵੇਂ ਵੈਸਟਰਨ ਕੰਟਰੀਜ ਨੇ ਉਹ ਵੀ ਇਹਨਾਂ ਤੋਂ ਨੋਨ ਹੋ ਸਕਣ ਅਨਨੋਨ ਨਾ ਰਹਿਣ ਨੋਨ ਸਕਣ ਕਿ ਉਹਨਾਂ ਦਾ ਵੀ ਮਨ ਭਾਵ ਹੈ ਕਿ ਉਹ ਪੰਜਾਬ ਆਉਣ ਜਾਂ ਆਪਣੇ ਭਾਰਤ ਵਿੱਚ ਆਉਣ ਭਾਰਤ ਵਿੱਚ ਜਿਵੇਂ ਸਾਊਥ ਏਰੀਆ ਵੱਲ ਬਨੈਨਾ ਲੀਵਜ 'ਤੇ ਰੱਖ ਕੇ ਕੁਛ ਖਾਂਦੇ ਹਨ ਜਾਂ ਉੱਥੋ ਦੀਆਂ ਕਲਾਵਾਂ ਨੇ ਜੋ ਵੀ ਹੈ ਚੋਕ ਪੂਰਨਾ ਵਗੈਰਾ ਜੋ ਰਿਚੁਅਲਸ ਨੇ ਜੋ ਰੀਤੀ ਰਿਵਾਜ਼ ਨੇ ਉਹਨਾਂ ਸਾਰੀਆਂ ਚੀਜ਼ਾਂ ਦਾ ਅਸੀਂ ਦੂਜਿਆਂ ਨੂੰ ਜ਼ਰੂਰ ਦਰਸਾਉਣਾ ਚਾਹਵਾਂਗੇ ਕਿ ਉਹ ਵੀ ਪ੍ਰੇਰਿਤ ਹੋਣ ਉਹਨਾਂ ਦਾ ਵੀ ਜੀਅ ਕਰੇ ਕਿ ਜਿਵੇਂ ਅੱਜ ਕੱਲ੍ਹ ਭਾਰਤ ਦੇ ਜ਼ਿਆਦਾਤਰ ਵਿਦੇਸ਼ਾਂ ਵਿੱਚ ਜਾ ਰਹੇ ਅਤੇ ਵਿਦੇਸ਼ ਦੇ ਜਿਹੜੇ ਲੋਕ ਆ ਉਹਨਾਂ ਦਾ ਵੀ ਜੀਅ ਕਰੇ ਕਿ ਅਸੀਂ ਇੱਥੇ ਆਈਏ ਤਾਂ ਅਸੀਂ ਜ਼ਰੂਰ ਦਿਖਾਉਣਾ ਚਾਹਵਾਂਗੇ